ਹਾਂਜੀ ਅਤੇ ਯੋਗਾ ਨੇ ਸਾਡੀ ਨੀਂਦ ਨੂੰ ਬਹੁਤ ਪ੍ਰਭਾਵਿਤ ਕੀਤਾ ਸਾਨੂੰ ਯੋਗਾ ਕਰਨ ਦੇ ਨਾਲ ਬਹੁਤ ਵਧੀਆ ਨੀਂਦ ਆਉਂਦੀ ਹੈ ਯੋਗਾ ਨਾਲ ਅਸੀਂ ਡਿਪ੍ਰੈਸ਼ਨ ਤੋਂ ਬਚਦੇ ਹਾਂ ਜਦੋਂ ਸਾਨੂੰ ਕੋਈ ਡਿਪ੍ਰੈਸ਼ਨ ਹੀ ਨਹੀਂ ਤਾਂ ਫਿਰ ਸਾਨੂੰ ਨੀਂਦ ਆਟੋਮੇਟਿਕੀ ਆਉਂਦੀ ਹੈ ਅਤੇ ਕੀ ਨਾਂ ਲੈਂਦੇ ਉਹ ਆਪਣਾ ਯੋਗਾ ਕਰਦਿਆਂ ਇਹ ਇਹ ਹੈ ਕਿ ਯੋਗਾ ਸਾਡੀ ਜ਼ਿੰਦਗੀ ਦਾ ਬਹੁਤ ਹੀ ਜ਼ਰੂਰੀ ਅੰਗ ਹੈ ਕਿਉਂਕਿ ਜੇ ਸਾਡਾ ਸਰੀਰ ਤੰਦਰੁਸਤ ਹੈ ਤਾਂ ਫਿਰ ਅਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਜਾ ਸਕਦੇ ਹਾਂ ਪਰਿਵਾਰ ਪਾਲ ਸਕਦੇ ਹਾਂ ਅਤੇ ਉਹ ਜਦੋਂ ਅਸੀਂ ਯੋਗਾ ਕਰਦੇ ਹਾਂ ਤਾਂ ਅਸੀਂ ਸਰੀਰ ਥੱਕਦਾ ਸਾਨੂੰ ਗੂੜੀ ਨੀਂਦ ਆਉਂਦੀ ਹੈ ਅਤੇ ਬ ਸਾਨੂੰ ਕੋਈ ਚਿੰਤਾ ਟੈਨਸ਼ਨ ਟੈਨਸ਼ਨ ਤੋਂ ਦੂਰ ਹੋ ਜਾਂਦੇ ਹਾਂ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਵੱਧ ਤੋਂ ਵੱਧ ਅਸੀਂ ਕੰਮ ਕਰ ਸਕਦੇ ਹਾਂ ਅਤੇ ਇਹ ਹੋ ਗਿਆ ਵੀ ਕੀ ਨਾਂ ਲੈਂਦੇ ਇਹਦੇ ਵਿੱਚ ਅਸੀਂ ਇੱਕ ਸ਼ਵ ਆਸਣ ਕਰਦੇ ਹੁੰਦੇ ਹਾਂ ਅਤੇ ਸੂਰਿਆ ਨਮਸਕਾਰ ਕਰਦੇ ਹਾਂ ਇਹਦੇ ਵਿੱਚ ਸਾਰੇ ਹੀ ਆ ਜਾਂਦੇ ਸਭ ਨਾਲੋਂ ਵਧੀਆ ਆਸਨ ਹੈ ਸੂਰਿਆ ਨਮਸਕਾਰ ਅਤੇ ਇੱਕ ਇਹ ਇਹਦੇ ਵਿੱਚ ਨੀਂਦ ਦੇ ਆਸਣ ਹੋ ਗਏ ਆਪਣੇ ਯੋਗ ਨੀਂਦਰਾ ਹੋ ਗਈ ਬੇਬੀ ਪੋਜ ਹੋ ਗਿਆ ਵਲ ਆਸਣ ਹੋ ਗਿਆ ਅਤੇ ਪ੍ਰਾਣਾਯਾਮ ਵਿੱਚ ਆਪਾਂ ਕਰਦੇ ਹੁੰਦੇ ਹਾਂ ਅਨੁਲੋਮ ਵਿਲੋਮ ਕਰੀਦਾ ਹੈ ਅਤੇ ਸ਼ਕਤੀ ਮੁਦਰਾ ਕਪਾਲਭਾਤੀ ਕਰ ਲਈਦਾ ਹੈ ਅਤੇ ਇਹਦੇ ਨਾਲ ਸਾਨੂੰ ਬਹੁਤ ਵਧੀਆ ਨੀਂਦ ਆਉਂਦੀ ਹੈ ਅਤੇ ਪ੍ਰਾਣ ਅਤੇ ਜੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਅਸੀਂ ਯੋਗਾ ਕਰਦੇ ਰਹੀਏ ਤਾਂ ਅਤੇ ਯੋਗਾ ਕਰਨ ਨਾਲ ਸਾਡੀ ਇਹ ਪਰਿਵਾਰ ਦੇ ਵਿੱਚ ਮੈਂਬਰਾਂ ਦੀ ਸ਼ੂਗਰ ਠੀਕ ਹੋਈ ਹੈ ਬਹੁਤ ਅਤੇ ਕਈਆਂ ਦਾ ਬੀ ਪੀ ਠੀਕ ਰਹਿੰਦਾ ਬੀ ਪੀ ਵੀ ਠੀਕ ਹੋਇਆ ਅਤੇ ਸਾਨੂੰ ਬਹੁਤ ਫਰਕ ਪਿਆ ਯੋਗਾ ਦੇ ਆਸਣ ਕਰਨ ਦੇ ਨਾਲ ਜਦੋਂ ਦੇ ਅਸੀਂ ਯੋਗ ਸ਼ੁਰੂ ਕੀਤਾ ਅਤੇ ਉਦੋਂ ਉਦੋਂ ਦਾ ਪਰਿਵਾਰ ਦੇ ਵਿੱਚ ਸਾਰੇ ਤੰਦਰੁਸਤ ਅਤੇ ਅਸੀਂ ਆਪਣਾ ਖੁਸ਼ੀ ਖੁਸ਼ੀ ਜੀਵਨ ਬਤੀਤ ਕਰਦੇ ਹਾਂ ਇਸ ਕਰਕੇ ਯੋਗਾ ਸਾਡੀ ਜ਼ਿੰਦਗੀ ਦਾ ਬਹੁਤ ਹੀ ਇੱਕ ਜ਼ਰੂਰੀ ਅੰਗ ਹੈ ਅਤੇ ਇਸਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਅਤੇ ਇਸ ਤੋਂ ਅਸੀਂ ਬਹੁਤ ਹੀ ਪ੍ਰਭਾਵਿਤ ਹੋਏ ਹਾਂ ਅਤੇ ਅਸੀਂ ਯੋਗਾ ਰੁਟੀਨ ਦੇ ਵਿੱਚ ਕਰਦੇ ਹਾਂ ਅਤੇ ਹੁਣ ਸਾਨੂੰ ਇਹਦੇ ਨਾਲ ਬਹੁਤ ਫਰਕ ਹੈ